ਸਤਿ ਸ਼੍ਰੀ ਅਕਾਲ ਜੀ ਓਲਾ ਕੈਬ ਸਰਵਿਸ ਤੋਂ ਗੱਲ ਕਰ ਰਹੇ ਤੁਸੀਂ ਜੀ ਮੈਂ ਗੁਰਵਿੰਦਰ ਸਿੰਘ ਗੱਲ ਕਰ ਰਿਹਾ ਬਠਿੰਡਾ ਤੋਂ ਹਾਂ ਜੀ ਦੇਰ ਰਾਤ ਅਸੀਂ ਕੱਲ੍ਹ ਕਿਸੇ ਫੰਕਸ਼ਨ 'ਤੇ ਗਏ ਹੋਏ ਸੀ ਹਾਂ ਅਸੀਂ ਮੇਰੀ ਫੈਮਿਲੀ ਮੇਰੇ ਬੱਚੇ ਨਾਲ ਸੀ ਅਸੀਂ ਉਸ ਫੰਕਸ਼ਨ ਤੋਂ ਕਾਫ਼ੀ ਲੇਟ ਹੋ ਗਏ ਤਾਂ ਔਨ ਦੀ ਸਪੋਟ ਅਸੀਂ ਮੌਕੇ 'ਤੇ ਔਨਲਾਈਨ ਤੁਹਾਡੀ ਕੈਬ ਬੁੱਕ ਕੀਤੀ

ਔਰ ਇਸ ਇਸ ਲਈ ਫੋਨ ਕੀਤਾ ਤੁਹਾਨੂੰ ਅਸੀਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ ਉਸ ਡਰਾਈਵਰ ਵੀਰ ਦਾ ਵੀ ਉਸ ਵੀਰ ਦਾ ਨਾਮ ਸ਼ਾਇਦ ਰਣਜੀਤ ਸਿੰਘ ਸੀਗਾ ਮੈਂ ਪੁੱਛਿਆ ਸੀ ਜੀ ਹਾਂ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਡਰਾਈਵਿੰਗ ਕੀਤੀ ਕਿਤੇ ਰੁਕੇ ਨਹੀਂ ਔਰ ਸਮੇਂ ਸਿਰ ਅਸੀਂ ਘਰ ਪਹੁੰਚ ਗਏ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਸ ਹਿਸਾਬ ਨਾਲ ਮਾਹੌਲ ਚੱਲ ਰਿਹਾ ਜੀ ਤੁਹਾਨੂੰ ਪਤਾ ਹੀ ਹੈ ਬੰਦਾ ਸੁਰੱਖਸ਼ਿਤ ਘਰ ਪਹੁੰਚਣਾ ਚਾਹੁੰਦਾ

ਵੀ ਬਹੁਤ ਅੱਛੀ ਸਰਵਿਸ ਵੀ ਬੜਾ ਡੀਸੈਂਟ ਪਰਸਨ ਸੀ ਅਤੇ ਬੱਚੇ ਪਰਿਵਾਰ ਨੇ ਵੀ ਕਿਹਾ ਹੈ ਵੀ ਬਹੁਤ ਅੱਛਾ ਤਾਂ ਇਸ ਲਈ ਉਹਨਾਂ ਦਾ ਧੰਨਵਾਦ ਤੁਹਾਡਾ ਵੀ ਧੰਨਵਾਦ ਜਦੋਂ ਵੀ ਸਾਨੂੰ ਅੱਗੇ ਤੋਂ ਲੋੜ ਪਏਗੀ ਅਸੀਂ ਤੁਹਾਡੀ ਹੀ ਕੈਬ ਬੁੱਕ ਕਰਨੀ ਹੈ ਜੀ ਹਾਂ ਬਹੁ ਬਹੁਤ ਬਹੁਤ ਵਧੀਆ ਜੀ ਧੰਨਵਾਦ ਕਹਿ ਦੇਣਾ ਮੇਰੇ ਵੱਲੋਂ ਡਰਾਈਵਰ ਭਾਈ ਸਾਹਿਬ ਨੂੰ ਧੰਨਵਾਦ ਜੀ